ਮੈਂ ਤਾਂ ਇਹ ਸੋਚਦਾ ਹੈਗਾ ਜਿਹੜਾ ਭਾਰਤ ਦਾ ਜਿਹੜਾ ਕੱਪੜਿਆਂ ਦਾ ਪਹਿਰਾਵਾ ਹੈਗਾ ਹੈ ਉਹ ਬੜਾ ਵਧੀਆ ਪਹਿਰਾਵਾ ਹੈਗਾ ਹੈ ਇੱਥੇ ਦੇ ਜਿਹੜੇ ਲੋਕ ਸੀਗੇ ਬੜੇ ਵਧੀਆ ਹੈਗੇ ਹੈ ਮਿਲਣਸਾਰ ਹੈਗੇ ਹੈ ਅਤੇ ਜਿਹੜੇ ਕੰਫਰਟੇਬਲ ਜਿਹੇ ਕੱਪੜੇ ਪਾਉਂਦੇ ਹੈਗੇ ਆ ਉਹ ਇੱਥੇ ਜਿਹੜਾ ਹੁਣ ਜਿੱਦਾਂ ਹੁਣ ਮੰਨ ਲਉ ਜਿਹੜਾ ਪੰਜਾ ਮਤਲਬ ਇੰਡੀਆ ਹੈਗਾ ਭਾਰਤ ਹੈਗਾ ਆਪਣਾ ਇਹ ਜਿਹੜਾ ਬ੍ਰਿਟਿਸ਼ ਦਾ ਕਾਫੀ ਟਾਈਮ ਤੋਂ ਗੁਲਾਮ ਰਿਹਾ ਹੈਗਾ ਇਸ ਕਰਕੇ ਜਿਹੜਾ ਹੈਗਾ ਇੱਥੇ ਤਾਂ ਥੋੜ੍ਹਾ ਬਹੁਤਾ ਪ੍ਰਭਾਵ ਤਾਂ ਜੀ ਫਿਰ ਉੱਥੇ ਦਾ ਹੋਵੇਗਾ ਹੀ ਮਾੜਾ ਮੋਟਾ ਪੱਛਮੀ ਉਹਦਾ ਸੱਭਿਅਤਾ ਦਾ ਜਿਹੜਾ ਪੱਛਮੀ ਫੈਸ਼ਨ ਹੈ ਉਹ ਨਾ ਇੱਥੇ ਕਾਫੀ ਤਰ੍ਹਾਂ ਨਾਲ ਇਹਨਾਂ ਨੂੰ ਪ੍ਰਭਾਵਿਤ ਕੀਤਾ ਹੈਗਾ ਹੈ ਜਿੱਦਾਂ ਹੁਣ ਵਿੰਗੇ ਟੇਢੇ ਵਾਲ ਹੋ ਗਏ ਕੱਪੜਿਆਂ ਦਾ ਹੋ ਗਿਆ ਇਹ ਤੋਂ ਇਲਾਵਾ ਹੋਰ ਵੀ ਕਾਫੀ ਤਰ੍ਹਾਂ ਇਹਨੇ ਪ੍ਰਭਾਵਿਤ ਕੀਤਾ ਹੈਗਾ ਹੈ ਜਿਹੜੇ ਪਸ ਜਿੱਦਾਂ ਮੈਂ ਹੁਣ ਕੱਪੜੇ ਜਿਹੜਾ ਮੈਂ ਲੈਂਦਾ ਹੈਗਾ ਮੈਂ ਤਾਂ ਇੱਥੇ ਨਵਾਂਸ਼ਹਿਰ ਬਲਾਚੋਰ 'ਤੇ ਇੱਕ ਮੇਰਾ ਦੋਸਤ ਹੈਗਾ ਹੈ ਉਹਨੇ ਕੱਪੜੇ ਦੀ ਦੁਕਾਨ ਕੀਤੀ ਹੈਗੀ ਹੈ ਬੜੇ ਵਧੀਆ ਭਾਅ ਜੀ ਕੱਪੜੇ ਰੱਖਦਾ ਹੈਗਾ ਹੈ ਉਹ ਉੱਥੋਂ ਮੈਂ ਕੱਪੜੇ ਲੈਂਦਾ ਹੈਗਾ ਜੀ ਉਹ ਤੋਂ ਅਤੇ ਮੈਨੂੰ ਜਿਹੜੇ ਖੁੱਲ੍ਹੇ ਡੁੱਲੇ ਮਤਲਬ ਠੀਕ ਠਾਕ ਜਿਹੇ ਹੋਣ ਜ਼ਿਆਦਾ ਖੁੱਲ੍ਹੇ ਨਾ ਹੋਣ ਕੰਫਰਟੇਬਲ ਜਿਹਾ ਬੰਦਾ ਰਹੇ ਮੈਨੂੰ ਉਸ ਤਰ੍ਹਾਂ ਦੇ ਕੱਪੜੇ ਪਹਿਨਣਾ ਬੜਾ ਪਸੰਦ ਹੈਗਾ ਜੀ ਮੈਨੂੰ ਵਧੀਆ ਲੱਗਦਾ ਹੈਗਾ ਉੱਦਾਂ ਦੇ ਕੱਪੜੇ ਪਹਿਨਣੇ ਮੈਂ ਤਾਂ ਇਹੀ ਕਹੂੰਗਾ ਜੇ ਕਿਸੇ ਬੰਦੇ ਨੇ ਮਤਲਬ ਹੋਰ ਕਿਸੇ ਬੰਦੇ ਨੇ ਵੀ ਕੱਪੜੇ ਲੈਣੇ ਹੋਣ ਤਾਂ ਬਲਾਚੋਰ ਇੱਥੇ ਹੈਗੀ ਹੈ ਉਹਦੀ ਗੋਲਡੀ ਗਾਰਮੈਂਟਸ ਦੀ ਦੁਕਾਨ ਹੈਗੀ ਹੈ ਉੱਥੋਂ ਉੱਥੋਂ ਕੱਪੜੇ ਲਉ ਬੜੇ ਵਧੀਆ ਕੱਪੜੇ ਦਿੰਦਾ ਅਤੇ ਬੜੇ ਵਧੀਆ ਰੇਟਾਂ 'ਤੇ ਦਿੰਦਾ ਹੈਗਾ ਹੈ